ਹਾਂ ਅਸੀਂ ਧਾਰਮਿਕ ਪੁਸਤਕ ਵਿੱਚੋਂ ਇੱਕ ਸਲੋਕ ਪੜ੍ਹਿਆ ਹੈ ਇਹ ਭਗਵਤ ਪੁਰਾਨ ਭਗਵਤ ਗੀਤਾ ਦੇ ਵਿੱਚੋਂ ਦਰਜ ਹੈ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਜਦੋਂ ਕਿ ਅਰਜਨ ਯੁੱਧ ਦੇ ਵਿੱਚੋਂ ਆਪਣਾ ਮੂੰਹ ਮੋੜਦਾ ਹੈ ਕਿ ਉਸ ਦੇ ਸਾਹਮਣੇ ਜਿਨ੍ਹਾਂ ਦੇ ਨਾਲ ਉਸਨੇ ਲੜਨਾ ਹੈ ਇਹ ਸਾਰੇ ਉਸਦੇ ਆਪਣੇ ਚਾਚਾ ਦਾਦਾ ਕਾਕਾ ਉਸਦੇ ਆਪਣੇ ਹੀ ਸਾਰੇ ਭੈਣ ਭਰਾ ਹਨ ਉਹ ਉਹਨਾਂ ਦੇ ਨਾਲ ਯੁੱਧ ਨਹੀਂ ਕਰ ਸਕਦਾ ਤਾਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਦਾ ਮੋਹ ਭੰਗ ਕਰਨ ਦੇ ਲਈ ਗੀਤਾ ਦੇ ਵਿੱਚ ਇੱਕ ਉਪਦੇਸ਼ ਦਿੱਤਾ ਕਰ ਮੰਨੇ ਵਾਦੀ ਕਾ ਰਸਤੇ ਮਾਫ ਲੇਸ਼ੂ ਕੋ ਅਰਜਨ ਜਿਸ ਦਾ ਮਤਲਬ ਹੈ ਕਿ ਹੇ ਅਰਜਨ ਤੂੰ ਆਪਣਾ ਕਰਮ ਕਰਦਾ ਚੱਲ ਫਲ ਦੀ ਇੱਛਾ ਨਾ ਕਰ ਭਾਵ ਮਨੁੱਖ ਨੂੰ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ ਕਦੇ ਵੀ ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ ਜੋ ਸਾਡਾ ਕਰਮ ਹੈ ਆਪ ਸਾਡਾ ਜੋ ਅਧਿਆਪਨ ਦਾ ਕਿੱਤਾ ਹੈ ਅਸੀਂ ਪੜ੍ਹਾਉਣਾ ਹੈ ਉਹ ਸਾਨੂੰ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਤਾਂ ਆਪਣਾ ਕੰਮ ਪੂਰਾ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਡਾ ਸਾਡੇ ਬੱਚਿਆਂ ਦਾ ਕੰਮ ਹੈ ਅਸੀਂ ਉਹਨਾਂ ਦੀ ਫਲ ਦੀ ਇੱਛਾ ਨਹੀਂ ਕਰਦੇ ਕਿ ਮੈਂ ਤਾਂ ਇਸਨੂੰ ਇੰਨਾ ਪੜਾ ਦਿੱਤਾ ਹੈ ਹਰ ਵੇਲੇ ਪਾਸ ਹੀ ਹੋਵੇ ਇਹ ਅਗਰ ਉਹ ਆਪਣਾ ਕਰਮ ਕਰੇਗਾ ਤਾਂ ਹੀ ਉਹ ਪਾਸ ਹੋਵੇਗਾ ਜੇਕਰ ਮਨੁੱਖ ਕਰਮ ਕਰੀ ਚੱਲੇ ਵਧੀਆ ਕੰਮ ਕਰੇ ਲੇਕਿਨ ਫਲ ਦੀ ਇੱਛਾ ਨਾ ਕਰੇ ਕਿ ਭਗਵਾਨ ਜੇ ਮੈਨੇ ਇਹ ਕਰਤਾ ਤਾਂ ਭਗਵਾਨ ਮੈਨੂੰ ਇਹ ਦੇਵੇ ਜੇ ਮੈਨੇ ਇਹ ਕਰਤਾ ਤਾਂ ਭਗਵਾਨ ਮੈਨੂੰ ਇਹ ਦੇਵੇ ਤਾਂ ਇਹਨਾਂ ਗੱਲਾਂ ਦੇ ਨਾਲ ਦਾ ਨਿਬੇੜਾ ਆਪਾਂ ਕਰਨ ਤੋਂ ਬਾਅਦ ਆਪਾਂ ਸਿਰਫ ਇਸੇ ਗੱਲ ਦੇ ਉੱਤੇ ਡਟੇ ਰਹੀਏ ਕਿ ਜੋ ਸਾਡਾ ਕਰਮ ਹੈ ਸਾਨੂੰ ਉਹ ਹੀ ਕਰਨਾ ਚਾਹੀਦਾ ਹੈ